ਰੂਪਨਗਰ ਜ਼ਿਲ੍ਹੇ ਦਾ ਜਿਹੜਾ ਮੌਸਮ ਹੈ ਇੱਥੋਂ ਦਾ ਤਾਪਮਾਨ ਬੜਾ ਵਧੀਆ ਹੈ ਇੱਥੇ ਹਰੇਕ ਤਰ੍ਹਾਂ ਦੀ ਰੁੱਤ ਆਉਂਦੀ ਹੈ ਹਰੇਕ ਤਰ੍ਹਾਂ ਦੀ ਰੁੱਤ ਐਕਸਟ੍ਰੀਮ 'ਤੇ ਆਉਂਦੀ ਹੈ ਕਠੋਰ ਹੁੰਦੀ ਹੈ ਮੇਰਾ ਜੋ ਇੱਥੋਂ ਦਾ ਅਨੁਭਵ ਹੈ ਕਿ ਦੁਨੀਆ ਵਿੱਚ ਕਿਤੇ ਵੀ ਚਲੇ ਜਾਓ ਪੰਜਾਬ ਦੇ ਇਸ ਰੂਪਨਗਰ ਜ਼ਿਲ੍ਹੇ ਵਰਗਾ ਮੌਸਮ ਕਿਤੇ ਨਹੀਂ ਹੈ ਪਰ ਅਜੋਕੇ ਸਮੇਂ ਵਿੱਚ ਹੁਣ ਤਬਦੀਲੀ ਆਉਂਦੀ ਜਾ ਰਹੀ ਹੈ ਗਰਮੀ ਦਾ ਸਮਾਂ ਵੀ ਘਟਦਾ ਜਾ ਰਿਹਾ ਹੈ ਸਰਦੀ ਦਾ ਸਮਾਂ ਵਧਦਾ ਜਾ ਰਿਹਾ ਹੈ ਮੌਸਮ ਵਿੱਚ ਤਬਦੀਲੀ ਇੱਥੇ ਵੇਖੀ ਜਾ ਸਕਦੀ ਹੈ